ਹਾਂਜੀ ਤੁਸੀਂ ਕੋਮਲ ਬੋਲਦੇ ਹਾਂਜੀ ਮੈਂ ਪਲਕ ਜਲੰਧਰ ਤੋਂ ਆਈ ਹਾਂ ਆਈ ਐਮ ਆ ਫੂਡ ਬਲੋਗਰ ਅਤੇ ਮੈਂ ਇਹ ਪੁੱਛਣਾ ਸੀਗਾ ਕਿ ਤੁਹਾਡੇ ਹੁਸ਼ਿਆਰਪੁਰ ਵਿੱਚ ਬੈਸਟ ਫਾਸਟਫੂਡ ਕਿੱਥੇ ਕਿੱਥੇ ਅਵੇਲੇਬਲ ਹੋਵੇਗਾ

ਹਾਂਜੀ ਅੱਛਾ ਅੱਛਾ ਸਾਢੇ ਪੰਜ ਅਤੇ ਨਾਈਟ ਦਸ ਗਿਆਰਾਂ ਵੱਜਦੇ ਹੋਣੇ ਹਾਂਜੀ ਅਤੇ ਮੈਨੂੰ ਪ੍ਰੋਪਰ ਲੋਕੇਸ਼ਨ ਦੱਸੋਗੇ ਕਿੱਦਾਂ ਲਾਈਕ ਕਿੱਥੋਂ ਜਾਣਾ ਉਹ ਹਾਂਜੀ ਹਾਂਜੀ ਹਾਂਜੀ ਅੱਛਾ ਓਕੇ ਜਿੱਥੇ ਰੈੱਡ ਕਰੋਸ ਵੀ ਆਉਂਦਾ ਉੱਥੇ ਹਾਂਜੀ ਹਾਂਜੀ

ਹਾਂਜੀ ਐਕਚੁਲੀ ਆਈ ਐਮ ਤਾਂ ਫੂਡ ਬਲੋਗਰ ਨਾ ਹਾਂ ਆਈ ਐਮ ਦਾ ਫੂਡ ਬਲੋਗਰ ਦੈਨ ਮਤਲਬ ਮੈਂ ਅਲੱਗ ਅਲੱਗ ਸਿਟੀਜ਼ ਵਿੱਚ ਜਾਂਦੀ ਹਾਂ ਫੂਡ ਅਪਰੋਚ ਕਰਨ ਅਤੇ ਹਾਂਜੀ ਅਤੇ ਮੇਰਾ ਹੁਸ਼ਿਆਰਪੁਰ ਵਿੱਚ ਪਹਿਲੀ ਵਾਰ ਆ ਇਸ ਵਾਰ ਹਾਂਜੀ ਅਤੇ ਮੈਨੂੰ ਤੁਹਾਡਾ ਕੰਟੈਕਟ ਸ਼ੋ ਹੋਇਆ ਫਿਰ ਮੈਂ ਤੁਹਾਡੇ ਤੋਂ ਪੁੱਛ ਰਹੀ ਹਾਂ ਹੁਣ ਹਾਂਜੀ ਅਤੇ ਹੋਰ ਕਿੱਦਾਂ ਫੂਡ ਵਗੈਰਾ ਦਾ ਹਾਂਜੀ ਹਾਂਜੀ ਜਿਸ ਹਿਸਾਬ ਨਾਲ ਰਸ਼ ਹੋਵੇਗਾ ਫਿਰ ਹੋਰ ਤਾਂ ਵਧੀਆ ਹੋਵੇਗਾ ਜੀ ਫਿਰ ਫੂਡ ਦੀ ਕੁਆਲਿਟੀ ਵਗੈਰਾ ਹਾਂਜੀ ਅੱਛਾ ਹਾਂਜੀ

ਅਤੇ ਹੋਰ ਤੁਸ ਹਾਂਜੀ ਹਾਂਜੀ ਹਾਂਜੀ ਫਸਟ ਟਾਈਮ ਹੁਸ਼ਿਆਰਪੁਰ ਆਏ ਮੈਨੂੰ ਤੁਹਾਡਾ ਕੋਂਟੈਕਟ ਵੀ ਹੋਇਆ ਅਤੇ ਫਿਰ ਮੈਂ ਤੁਹਾਨੂੰ ਤਾਂ ਕੋਂਟੈਕਟ ਕੀਤਾ ਮੈਂ ਜਲੰਧਰ ਜਲੰਧਰ ਤਾਂ ਮੈਂ ਰਹਿੰਦੀ ਆਪਣੇ ਲਿਵਿੰਗ ਦਾ ਜਲੰਧਰ ਫਗਵਾੜਾ ਲੁਧਿਆਣੇ ਸਾਰੀ ਜਗ੍ਹਾ ਮੈਂ ਜਾਂਦੀ ਹਾਂ ਅਪਰੋਚ ਕਰਦੀ ਹਾਂ ਬੈਸਟ ਦੇਖਦੀ ਹੁੰਦੀ ਉਸ ਸਿਟੀ ਦਾ ਬੈਸਟ ਕੀ ਆ ਅਤੇ ਮਤਲਬ ਫਿਰ ਸ ਵਲੋਗ ਸ਼ੂਟ ਕਰਦੀ ਹੈ ਦੈਨ ਅਪਲੋਡ ਕਰਦੀ ਹਾਂ ਹਾਂਜੀ ਫਾਸਟ ਫੂਡ ਹਰ ਇੱਕ ਆਈਟਮ ਮਿਲ ਜਾਂਦੀ ਉੱਥੇ ਹੈ ਨਾ ਅਤੇ ਸਾਰੀ ਫਰੈਸ਼ ਹਾਂਜੀ ਹਾਂਜੀ ਮਤਲਬ ਹਨੇਰੇ ਹੋਏ 'ਤੇ ਲਾਉਂਦੇ ਉਹ ਹਾਂਜੀ ਹਾਂਜੀ ਹਨੇਰੇ ਹੋਏ 'ਤੇ ਲੱਗਦਾ

ਹਾਂਜੀ ਹਾਂਜੀ ਅੱਛਾ ਅੱਛਾ ਅਤੇ ਹੋਰ ਤੁਸੀਂ ਵੀ ਇੱਥੋਂ ਹੀ ਖਾਂਦੇ ਹੋਰ ਕਿੱਥੋਂ ਰਹਿੰ ਕਿੱਥੇ ਰਹਿੰਦੇ ਤੁਸੀਂ ਚਲੋ ਫਿਰ ਮਿਲਦੇ ਹਾਂ ਕਦੇ ਕਿਸੇ ਦਿਨ ਮਿਲਿਆ ਤਾਂ ਟੈਮ ਇੱਕ ਮੈਂ ਜਿੱਥੇ ਨਿਊ ਕੋਟ ਬਣਿਆ ਉੱਥੇ ਹਾਂਜੀ ਰੂਮ ਲਿਆ ਰੈਂਟ 'ਤੇ ਹਾਂਜੀ ਓਕੇ ਓਕੇ ਬਾਏ